ਹੈਲੋ

ਹਾਂਜੀ ਨਮਸਤੇ ਜੀ ਹਾਂਜੀ ਹਾਂਜੀ ਹਾਂਜੀ ਸਾਨੂੰ ਜ਼ਰੂਰਤ ਹੈ ਇੱਕੋ ਦੀ ਤੁਸੀਂ ਇੱਕ ਵਾਰੀ ਜਿਹੀ ਰੈਸਟੋਰੈਂਟ ਆ ਕੇ ਨਾ ਤਾਂ ਮੈਂ ਸਾਰਾ ਕੁਝ ਦੱਸ ਦਿੰਦੀ ਹਾਂ ਵੈਸੇ ਕਿਵੇਂ ਕਰਨਾ ਇੱਕ ਦੋ ਦਿਨ ਦਾ ਡਰਦਾ ਇਕ ਵਾਰੀ ਡੈਮੋ ਹੋਏਗਾ ਮਤਲਬ ਤੁਹਾਨੂੰ ਅਬਜਰਵ ਕੀਤਾ ਜਾਏਗਾ ਅਸੀਂ ਕਸਟਮਰ ਨਾਲ ਕਿਵੇਂ ਡੀਲ ਕਰਦੇ ਹੋ ਠੀਕ ਹੈ ਵੈਸੇ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਡੀਲ ਕਰਨਾ ਹਾਂਜੀ ਜਦੋਂ ਵੀ ਆਪਣੇ ਰੈਸਟੋਰੈਂਟ 'ਚ ਕੋਈ ਵੀ ਕਸਟਮਰ ਆਏਗਾ ਫਸਟ ਆਫ ਆਲ ਤਾਂ ਤੁਸੀਂ ਉਹਨਾਂ ਨੂੰ ਪਹਿਲਾਂ ਪਾਣੀ ਪੁੱਛਣਾ ਠੀਕ ਹੈ ਫਿਰ ਉਹਨਾਂ ਨੂੰ ਤੁਸੀਂ ਇੱਕ ਮੈਨਿਊ ਦੇਣਾ ਅਤੇ ਤੁਹਾਡੇ ਕੋਲ ਤੁਹਾਡੀ ਖੁਦ ਦੀ ਡਾਇਰੀ ਅਤੇ ਇੱਕ ਪੈੱਨ ਹੋਏਗਾ ਤੁਸੀਂ ਸਾਰਾ ਮੈਨਿਊ ਬਹੁਤ ਹੀ ਧਿਆਨ ਨਾਲ ਲਿਖਣਾ ਸਾਰਾ ਤਾਂ ਕਿ ਕੋਈ ਵੀ ਗਲਤੀ ਨਾ ਹੋਵੇ ਉਸ 'ਚ ਜੋ ਵੀ ਤੁਹਾਨੂੰ ਕਸਟਮਰ ਕਹਿੰਦੇ ਤੁਸੀਂ ਉਹ ਸਾਰਾ ਕੁਝ ਉਹਦੇ 'ਚ ਲਿਖਣਾ ਏ ਫਿਰ ਅੱਗੇ ਆਰਡਰ ਰਿਸੈਪਸ਼ਨ 'ਤੇ ਦੇਣਾ ਠੀਕ ਹੈ ਅਤੇ ਲਾਸਟ ਵਿੱਚ ਬਿਲਿੰਗ ਵਗੈਰਾ ਤੁਹਾਨੂੰ ਸਾਰਾ ਕੁਝ ਬਿਲ ਦੀ ਪੇਮੈਂਟ ਉਹਨਾਂ ਨੂੰ ਦੇਣੀ ਪਏਗੀ ਠੀਕ ਹੈ ਸਾਰਾ ਕੁਝ ਕਸਟਮਰ ਕੋਲੋਂ ਤੁਸੀਂ ਲੈ ਕੇ ਫਿਰ ਉਹਨਾਂ ਨੂੰ ਦੇ ਦੇਣਾ ਠੀਕ ਹੈ ਹਾਂਜੀ ਅਤੇ ਤੁਹਾਨੂੰ ਵੈਸੇ ਤਾਂ ਸਾਰਾ ਕੁਝ ਪ੍ਰੋਵਾਈਡ ਹੋਏਗਾ ਜੇ ਤੁਹਾਡੀ ਜੋਬ ਲੱਗ ਜਾਂਦੀ ਹੈ ਤਾਂ ਵਧੀਆ ਤੁਹਾਨੂੰ ਸੈਲਰੀ ਵੀ ਦਿੱਤੀ ਜਾਏਗੀ ਹਾਂਜੀ ਤੁਸੀਂ ਪਹਿਲਾ ਕਿਤੇ ਕੰਮ ਕੀਤਾ ਹੋਰ ਅੱਛਾ ਅੱਛਾ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਦੋ ਤਿੰਨ ਦਿਨ ਆ ਕੇ ਦੇਖੋ ਕੁਛ ਤੁਸੀਂ ਵੀ ਦੇਖਿਆ ਜੇ ਅਤੇ ਕੁਛ ਅਸੀਂ ਅਬਜਰਵ ਕਰਾਂਗੇ ਫਿਰ ਤੁਹਾਨੂੰ ਅਸੀਂ ਉਦੋਂ ਹੀ ਦੱਸ ਦਾਂਗੇ ਦੋ ਤਿੰਨ ਦਿਨ ਬਾਅਦ ਹੀ ਹਾਂਜੀ ਬਾਕੀ ਸੈਲਰੀ ਦੀ ਤਾਂ ਕੋਈ ਦਿੱਕਤ ਨਹੀਂ ਹੈ ਸੈਲਰੀ ਵੀ ਤੁਹਾਨੂੰ ਵਧੀਆ ਮਿਲ ਜਾਏਗੀ ਜੇ ਤੁਹਾਡੇ ਸੈਟਿੰਗ ਹੋ ਜਾਂਦੀ ਹੈ ਤਾਂ ਬਾਕੀ ਜੇ ਤੁਹਾਡੇ ਨੋਨ 'ਚ ਵੀ ਕੋਈ ਇੱਕ ਦੋ ਜਣੇ ਹੋਰ ਹੈਗੇ ਤਾਂ ਤੁਸੀਂ ਲੈ ਕੇ ਆ ਸਕਦੇ ਹੋ ਉਹਨਾਂ ਨੂੰ ਵੀ ਕਿਉਂਕਿ ਸਾਨੂੰ ਤਿੰਨ ਚਾਰ ਬੰਦਿਆਂ ਦੀ ਜ਼ਰੂਰਤ ਸੀ ਹਾਂਜੀ ਹਾਂਜੀ ਠੀਕ ਹੈ ਜੀ